ਪੰਜਾਬ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਹਨ ਜੋ ਕਲਾਕਾਰਾਂ ਨੂੰ ਸਮਰਥਿਤ ਕਰਦੀਆਂ ਹਨ ਉਹਨਾਂ ਦੀ ਕਲਾ ਨੂੰ ਪ੍ਰੋਤਸ਼ਾਹਿਤ ਕਰਦੀਆਂ ਹਨ ਪਰ ਇਸਦੇ ਲਈ ਵੱਖ ਵੱਖ ਤਰ੍ਹਾਂ ਦੀਆਂ ਸੰਸਥਾਵਾਂ ਵੀ ਬਣੀਆਂ ਹੋਈਆਂ ਹਨ ਜਿਵੇਂ ਪੰਜਾਬ ਆਰਟ ਕੌਂਸਲ ਹੋ ਗਈ ਕਰਾਫਟਿੰਗ ਕਮਿਊਨਿਟੀ ਹੋ ਗਈ ਜਾਂ ਆਰਟ ਕਰਾਫ ਵਿਰਸਾ ਹੋ ਗਿਆ ਇਹਨਾਂ ਦਾ ਪ੍ਰਮੁੱਖ ਕੰਮ ਇਹ ਹੈ ਕਿ ਜਿਹੜੇ ਉੱਭਰ ਰਹੇ ਕਲਾਕਾਰ ਹਨ ਜਾਂ ਕਲਾ ਹੈ ਉਹਨਾਂ ਨੂੰ ਵੱਧ ਤੋਂ ਵੱਧ ਉਭਾਰਿਆ ਜਾ ਸਕੇ ਕਿਉਂਕਿ ਕਲਾ ਨੂੰ ਅੱਡ ਅੱਡ ਜਗ੍ਹਾ ਤੇ ਪਹੁੰਚਾਉਣ ਦਾ ਕੰਮ ਵੀ ਕੋਈ ਸੰਸਥਾ ਹੀ ਕਰ ਸਕਦੀ ਹੈ ਜੇ ਆਪਾਂ ਕਿਸੇ ਕਲਾਕਾਰ ਦੀ ਗੱਲ ਕਰੀਏ ਕਿਸੇ ਖੇਤਰੀ ਲੈਵਲ 'ਤੇ ਤਾਂ ਉਹ ਆਪਣਾ ਮੁਕਾਮ ਹਾਸਿਲ ਕਰ ਸਕਦਾ ਹੈ ਬਟ ਉਹਨੂੰ ਜੇ ਇਹ ਵੱਧ ਤੋਂ ਵੱਧ ਜਗ੍ਹਾ ਤੇ ਆਪਦੇ ਆਪ ਨੂੰ ਮਸ਼ਹੂਰ ਕਰਨਾ ਕਹਿ ਦਈਏ ਤਾਂ ਉਸ ਵਾਸਤੇ ਉਹਨੂੰ ਚਾਹੀਦਾ ਹੈ ਕਿਸੇ ਨਾ ਕਿਸੇ ਦਾ ਸਾਥ ਸਹਿਯੋਗ ਜਿਸਦੇ ਜਿਹੜਾ ਸਾਡਾ ਸਾਥ ਦੇ ਸਕਦਾ ਹੈ ਉਹ ਕਹਿ ਦਈਏ ਨੈਟਵਰਕ ਦੇ ਸਕਦਾ ਹੈ ਜਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਸੰਸਥਾ ਦੇ ਸਕਦੀ ਹੈ ਇਸ ਕਰਕੇ ਇਹ ਜਿਹੜੀਆਂ ਸੰਸਥਾਵਾਂ ਹਨ ਵੱਖ ਵੱਖ ਤਰ੍ਹਾਂ ਦੀਆਂ ਸੰਸਥਾਵਾਂ ਹਨ ਉਹ ਪੰਜਾਬ ਦੇ ਸੱਭਿਆਚਾਰ ਨੂੰ ਭਾਈਚਾਰੇ ਨੂੰ ਕਲਾ ਭਾਈਚਾਰੇ ਨੂੰ ਬਚਾਉਣ ਵਾਸਤੇ ਜਾਂ ਕਹਿ ਦਈਏ ਜਾਂ ਉਹਨਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਵਾਸਤੇ ਅੱਡ ਅੱਡ ਤਰ੍ਹਾਂ ਦਾ ਆਪਣਾ ਰੋਲ ਨਿਭਾ ਰਹੀਆਂ ਹਨ ਪੰਜਾਬ ਵਿੱਚ ਬਹੁਤ ਸਾਰੀਆਂ ਕਲਾ ਮੰਚ ਹਨ ਜਿਹੜੇ ਉੱਭਰ ਰਹੇ ਕਲਾਕਾਰਾਂ ਨੂੰ ਸੇਧ ਦਿੰਦੀਆਂ ਹਨ ਜਾਂ ਉਹਨਾਂ ਦੀ ਜਿਹੜੀ ਪ੍ਰਤਿਭਾ ਹੈ ਉਹ ਕਹਿ ਦਈਏ ਖਰਾਬ ਨਾ ਹੋਵੇ ਉਹਨਾਂ ਨੂੰ ਪ੍ਰੋਸ਼ਾਹਿਤ ਕਰਦੇ ਹਨ ਅੱਡ ਅੱਡ ਤਰ੍ਹਾਂ ਦੇ ਨਾਟਕ ਕਰਕੇ ਕਿਸੇ ਤਰ੍ਹਾਂ ਦੇ ਰੋਲ ਕਰਕੇ ਜਾਂ ਪਲੇਅ ਕਰਵਾ ਕੇ ਤਾਂ ਕਿ ਉਹਨਾਂ ਦਾ ਜਿਹੜਾ ਉਤਸ਼ਾਹ ਹੈ ਉਹ ਕਿਸੇ ਵੀ ਤਰ੍ਹਾਂ ਘੱਟ ਨਾ ਹੋਵੇ ਇਹਨਾਂ ਨੂੰ ਪ੍ਰੋਤਸ਼ਾਹਿਤ ਕਰਨ ਵਾਸਤੇ ਅੱਡ ਅੱਡ ਸੰਸਥਾਵਾਂ ਬਣੀਆਂ ਹੋਈਆਂ ਹਨ ਜਿੰਨਾਂ ਦਾ ਮੁੱਖ ਕੰਮ ਇਹੀ ਹੈ ਕਿ ਉਹ ਕਲਾਕਾਰਾਂ ਤੱਕ ਪਹੁੰਚ ਕਰਦੀਆਂ ਹਨ ਜਾਂ ਕਲਾਕਾਰ ਉਹਨਾਂ ਤੱਕ ਪਹੁੰਚ ਕਰਦੇ ਹਨ ਕਿ ਉਹਨਾਂ ਦਾ ਕਲਾ ਨੂੰ ਹਰ ਪਾਸੇ ਪਸਾਰ ਹੋ ਸਕੇ ਜਾਂ ਉਹਨਾਂ ਦੇ ਜਿਹੜੀ ਕਲਾ ਹੈ ਉਹ ਹੋਰ ਜਿਆਦਾ ਵਿਕਸਿਤ ਹੋ ਸਕੇ ਕਲਾ ਮੰਚ ਅੱਡ ਅੱਡ ਤਰ੍ਹਾਂ ਦੇ ਸਾਥੀ ਪ੍ਰਦਾਨ ਕਰਦੀਆਂ ਹਨ ਜਿਹੜੀਆਂ ਉਹਨਾਂ ਦੀ ਕਲਾ ਨੂੰ ਨਿਖਾਰਨ ਵਿੱਚ ਵੀ ਮੱਦਦ ਕਰਦੇ ਹਨ ਕਈ ਵਾਰੀ ਬਹੁਤ ਸਾਰੇ ਕਲਾਕਾਰ ਉੱਭਰਦੇ ਕਲਾਕਾਰ ਇਹੋ ਜਿਹੇ ਨੇ ਜਿੰਨਾਂ ਵਿੱਚ ਕੁਛ ਮੁੱਖ ਮੁੱਖ ਪੇਸ਼ੀਆਂ ਕਮੀਆਂ ਪੇਸ਼ੀਆਂ ਹੁੰਦੀਆਂ ਹਨ ਜਿਸ ਦੀ ਵਜ੍ਹਾ ਕਰਕੇ ਉਹ ਆਪਦਾ ਮੁਕੰਮਲ ਮੁਕਾਮ ਨਹੀਂ ਹਾਸਲ ਕਰ ਸਕਦੇ ਇਸ ਕਰਕੇ ਉਹ ਕਲਾਕਾਰ ਕਲਾ ਸੰਸਥਾਵਾਂ ਦੇ ਸਹਾਰੇ ਆਪਣੇ ਆਪ ਦੀ ਕਲਾ ਨੂੰ ਹੋਰ ਜਿਆਦਾ ਅੱਗੇ ਵਧਾ ਸਕਦੇ ਹਨ ਉਹਦੇ 'ਚ ਸੁਧਾਰ ਕਰ ਸਕਦੇ ਹੋ ਕਿਉਂਕਿ ਕਲਾ ਕਲਾ ਇੱਕ ਕਹਿ ਦਈਏ ਖੁਸ਼ੀ ਵੀ ਹੁੰਦੀ ਹੈ ਤੇ ਇੱਕ ਕਮਾਈ ਦਾ ਸਾਧਨ ਵੀ ਹੁੰਦਾ ਹੈ ਖੁਸ਼ੀ ਤਾਂ ਇਨਸਾਨ ਆਪਦੇ ਕੰਮ ਤੋਂ ਲੈ ਹੀ ਲੈਂਦਾ ਪਰ ਜੇ ਉਸਨੇ ਉਹਨੂੰ ਆਪਦਾ ਰੋਜ਼ਗਾਰ ਦਾ ਸਾਧਨ ਬਣਾਉਣਾ ਤੇ ਇਸ ਵਾਸਤੇ ਉਹ ਜਰੂਰੀ ਹੈ ਕੀ ਉਹ ਕਲਾ ਨੂੰ ਵੱਧ ਤੋਂ ਵੱਧ ਨਿਖਾਰਿਆ ਜਾ ਸਕੇ ਕਿਉਂਕਿ ਜਿਹੜਾ ਕਹਿ ਦਈਏ ਕਲਾ ਜਨ ਹੁੰਦਾ ਜਾਂ ਕਲਾ ਨੂੰ ਦੇਖਣ ਵਾਲਾ ਹੁੰਦਾ ਉਹ ਸਿਰਫ ਉਸ ਬੰਦੇ ਨੂੰ ਹੀ ਅੱਗੇ ਲੈ ਜਾਂਦਾ ਜਿਹਦੀ ਕਲਾ ਉਹਨੂੰ ਵਧੀਆ ਲੱਗਦੀ ਹੈ ਇਸ ਕਰਕੇ ਉਸ ਕਲਾ ਵਿੱਚ ਕਮੀਆਂ ਪੇਸ਼ੀਆਂ ਕੋਈ ਨਾ ਹੋਣ ਤਾਂ ਕਲਾ ਸੰਸਥਾਵਾਂ ਉਹਦੇ ਵਿੱਚ ਆਪਦਾ ਮਹੱਤਵਪੂਰਨ ਯੋਗਦਾਨ ਦਿੰਦੀਆਂ ਹਨ